ਹਾਂ ਮੇਰੇ ਪਿੰਡ ਦੇ ਮੇਰੇ ਨਾਲ ਦੇ ਪੜ੍ਹਾਈ ਕਰਦੇ ਸਾਥੀਆਂ ਨੇ ਮੇਰੇ ਮਿੱਤਰਾਂ ਨੇ ਮੇਰੇ ਦੋਸਤਾਂ ਨੇ ਮੇਰੇ ਨਾਲ ਦਾ ਜਿੰਨਾ ਵੀ ਦਾਇਰਾ ਹੈ ਮੈਂ ਜਿੰਨਿਆਂ ਨੂੰ ਵੀ ਮਿਲਿਆ ਉਹ ਹਰ ਇੱਕ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਰੁਚੀ ਤਾਂ ਰੱਖਦੇ ਨੇ ਜਿੱਦਾਂ ਕਿ ਮੈਂ ਭੰਗੜੇ ਦੇ ਵਿੱਚ ਦਾ ਸ਼ੌਂਕ ਰੱਖਦਾ ਅਤੇ ਮੈਂ ਵੈਸੇ ਵੀ ਆਪਣੇ ਪਰਸਨਲ ਨਿਖਾਰ ਦੇ ਲਈ ਆਪਣੇ ਅੰਦਰੂਨੀ ਨਿਖਾਰ ਦੇ ਲਈ ਮੈਂ ਅਲੱਗ ਅਲੱਗ ਗਤੀਵਿਧੀਆਂ ਵਿੱਚ ਭਾ ਹਿੱਸਾ ਲੈਂਦਾ ਰਹਿੰਦਾ ਏ ਜਿਵੇਂ ਕਿ ਹੁਣ ਮੇਰੇ ਕਾਫੀ ਸਾਥੀ ਸੀ ਜਿਨ੍ਹਾਂ ਨੇ ਮੋਡਲਿੰਗ ਵਿੱਚ ਪਾਰਟੀਸਪੇਟ ਕੀਤਾ ਕਿਸੇ ਨੇ ਕਿਸੇ ਭੰਗੜੇ ਵਿੱਚ ਕਿਸੇ ਨੇ ਗਿੱਧੇ ਵਿੱਚ ਕਿਸੇ ਨੇ ਕਲਾਵਾਂ ਵਿੱਚ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਹਰ ਇੱਕ ਨੇ ਆਪਣਾ ਆਪਣਾ ਪ੍ਰਦਰਸ਼ਨ ਕੀਤਾ ਅਤੇ ਹਰ ਇੱਕ ਦਾ ਆਪਣਾ ਆਪਣਾ ਨਤੀਜਾ ਹੁੰਦਾ ਹੈ ਅਤੇ ਹਰ ਇੱਕ ਦਾ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਜਿਵੇਂ ਹੁਣ ਮ ਮੈਂ ਦੱਸਾਂ ਕਿ ਜੇ ਆਪਾਂ ਕਿਸੇ ਚੀਜ਼ ਨੂੰ ਵੀ ਦਿਲੋਂ ਕਰਦੇ ਹਾਂ ਤਾਂ ਉਹ ਅਪ ਆਪ ਆਪਣੇ ਆਪ ਖੁਦ ਬ ਖੁਦ ਆ ਜਿਹੜਾ ਉਹਦਾ ਨਿਖਾਰ ਆ ਜਿਹੜਾ ਪ੍ਰਦਰਸ਼ਨ ਹੁੰਦਾ ਉਹ ਪੂਰੇ ਪਰੋ ਪੂਰੇ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਪੇਸ਼ ਆਉਂਦਾ ਪੇਸ਼ ਹੁੰਦਾ ਹੁਣ ਮੈਂ ਦੇਖਿਆ ਜਾਵੇ ਤਾਂ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਜ਼ਿਆਦਾਤਰ ਤਾਂ ਬਾਹਰਲੀ ਗਤੀਵਿਧੀਆਂ ਵੱਲ ਧਿਆਨ ਰੱਖਦੇ ਨੇ ਜਿੱਦਾਂ ਕਿ ਹੁਣ ਜਿਹੜਾ ਨਵੇਂ ਗੀਤ ਆ ਰਹੇ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਅ ਦੇਸ਼ ਦੇ ਵਿੱਚ ਜਾਂ ਜ਼ਿਆਦਾਤਰ ਬਾਹਰਲੇ ਮੁਲਕਾਂ ਦਾ ਪ੍ਰਭਾਵ ਹੈ ਜਿਹੜਾ ਆਪਣੇ ਭਾਰਤ ਉਤੇ ਪੈ ਰਿਹਾ ਹੈ ਜਿਹਦੇ ਨਾਲ ਕਾਫੀ ਹੱਦ ਤੱਕ ਜਿਹੜਾ ਇਹ ਪੰਜਾਬ ਦਾ ਕਲਚਰ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਕੁਛ ਹੱਦ ਤੱਕ ਕਾਫੀ ਥੱਲੇ ਨੂੰ ਜਾ ਰਿਹਾ ਪਰ ਹਾਂ ਆਪਾਂ ਇਸ ਨੂੰ ਉਭਾਰਨ ਵਾਸਤੇ ਅਲੱਗ ਅਲੱਗ ਯੂਨੀਵਰਸਿਟੀਆਂ ਮਿਲ ਕੇ ਸਰਕਾਰ ਮਿਲ ਕੇ ਇਹਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਅਤੇ ਇਹ ਸਹੀ ਹੈ ਕਿ ਜਿੰਨਾ ਵੀ ਆਪਾਂ ਪ ਅ ਨਵੀਆਂ ਨਵੀਆਂ ਚੀਜ਼ਾਂ ਸਿੱਖਾਂਗੇ ਤਾਂ ਉੱਨਾ ਹੀ ਆਪਣੇ ਪਰਸਨੈਲਿਟੀ ਦੇ ਨਿਖਾਰ ਆਉਂਦਾ